ਮੇਰੇ ਗਾਉਣ ਲਈ ਪਸੰਦੀਦਾ ਸ਼ੈਲੀ ਪੰਜਾਬੀ ਵਿੱਚ ਹੈ ਕਿਉਂਕਿ ਪੰਜਾਬੀ ਮੈਨੂੰ ਸਮਝ ਆਉਂਦੀ ਹੈ ਬਹੁਤ ਚੰਗੀ ਤਰੀਕੇ ਨਾਲ ਕਿ ਬੰਦਾ ਕੀ ਬੋਲ ਰਿਹਾ ਕੀ ਨਹੀਂ ਬੋਲ ਰਿਹਾ ਇਹ ਸਾਨੂੰ ਬਿਲਕੁਲ ਸਮਝ ਆ ਰਹੀ ਹੈ ਕਿਉਂਕਿ ਜੇ ਬੰਦਾ ਕੁਛ ਬੋਲ ਰਿਹਾ ਤਾਂ ਅਸੀਂ ਆਪਣੀ ਆਵਾਜ਼ ਉਠਾ ਸਕਦੇ ਕਿ ਸਾਨੂੰ ਪਤਾ ਲੱਗ ਸਕੇ ਕਿ ਹਾਂ ਇਹ ਬਿਲਕੁਲ ਸਹੀ ਬੋਲ ਰਿਹਾ ਅਤੇ ਸਾਨੂੰ ਸਹੀ ਲੱਗ ਰਿਹਾ ਅਤੇ ਕੀ ਇਹ ਗਲਤ ਤਾਂ ਨਹੀਂ ਬੋਲ ਰਿਹਾ ਕਿਉਂ ਕਿਉਂਕਿ ਪੰਜਾਬੀ ਸਾਨੂੰ ਬਹੁਤ ਚੰਗੀ ਤਰ੍ਹਾਂ ਆਉਂਦੀ ਹੈ ਲਿਖਣੀ ਵੀ ਆਉਂਦੀ ਹੈ ਵੈਸੇ ਵੀ ਆਪਾਂ ਪੰਜਾਬ ਦੇ ਵਾਸੀ ਹਾਂ ਹੈ ਨਾ ਅਤੇ ਪੰਜਾਬ ਦੇ ਵਾਸੀਆਂ ਨੂੰ ਪੰਜਾਬੀ ਤਾਂ ਬਿਲਕੁਲ ਆਉਣੀ ਚਾਹੀਦੀ ਹੈ ਚੰਗੀ ਤਰੀਕੇ ਨਾਲ ਆਉਣੀ ਚਾਹੀਦੀ ਹੈ ਉਹਨਾਂ ਦੇ ਖੂਨ ਰਗਾਂ ਰਗਾਂ ਦੇ ਵਿੱਚ ਪੰਜਾਬੀ ਹੋਣੀ ਚਾਹੀਦੀ ਹੈ ਨਾ ਅਤੇ ਇਸ ਲਈ ਮੈਨੂੰ ਸਭ ਤੋਂ ਜ਼ਿਆਦਾ ਪੰਜਾਬੀ ਇਸ ਲਈ ਪਸੰਦ ਆ ਨਾ ਪੰਜਾਬੀ ਗਾਣੇ ਇਸ ਲਈ ਪਸੰਦ ਆ ਕਿਉਂਕਿ ਨਾ ਉਹ ਸਾਡੇ ਜਜ਼ਬਾਤ ਜੋ ਹੁੰਦੇ ਜੋ ਸਾਡੇ ਜਜ਼ਬਾਤ ਹੁੰਦੇ ਨਾ ਉਹ ਸਾਨੂੰ ਉਹਨਾਂ ਦੇ ਸਾਹਮਣੇ ਨਾ ਪ੍ਰਸਤੁਤ ਕਰ ਦਿੰਦੇ ਕੋਈ ਚੰਗੀ ਤਰ੍ਹਾਂ ਕਿ ਸਾਨੂੰ ਜੋ ਆਪਾਂ ਆਪਣੇ ਅੰਦਰ ਅੰਦਰ ਅੰਦਰ ਅੰਦਰ ਅੰਦਰ ਸੋਚ ਰਹੇ ਹੁੰਦੇ ਹਾਂ ਉਹ ਉਹੀ ਸਭ ਕੁਛ ਉਸ ਗਾਣਿਆਂ ਦੇ ਵਿੱਚ ਉਸੀ ਭਾਸ਼ਾ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਦਰਸਾਇਆ ਜਾਂਦਾ ਜਿੱਦਾਂ ਕਿ ਹੁਣ ਮੇਰਾ ਬਹੁਤ ਜ਼ਿਆਦਾ ਵਧੀਆ ਗਾਣਾ ਸੀਗਾ ਇਕ ਗਾਣਾ ਸੀ ਬਹੁਤ ਜ਼ਿਆਦਾ ਵਧੀਆ ਸੀ ਜੋ ਕਿ ਪੰਜਾਬੀ ਦੇ ਵਿੱਚ ਸੀਗਾ ਨਾ ਅਤੇ ਉਹ ਗਾਣਾ ਸੀਗਾ ਮੈਂ ਕਰ ਕੇ ਫਲਾਈ ਆਵਾਂ ਅਤੇ ਜਿੱਦਾਂ ਮੈਂ ਹੁਣ ਮੈਂ ਕਿਸੇ ਨੂੰ ਜੇ ਪਿਆਰ ਕਰਾਂਗੀ ਹੈ ਨਾ ਉਹ ਮੈਨੂੰ ਬੁਲਾਇਆ ਕਰੇ ਕਿ ਤੂੰ ਆ ਜਾ ਤਾਂ ਮੈਂ ਐਸੇ ਕਰਾਂਗੀ ਨਾ ਮੈਂ ਆ ਗਈ ਮੈਂ ਫਟਾਫਟ ਆ ਗਈ ਮੈਂ ਹੁਣੀ ਆ ਗਈ ਅਤੇ ਮੈਂ ਕਹਾਂ ਮੈਂ ਕਰਕੇ ਫਲਾਈ ਆਵਾਂ